ਚਿੱਤਰਕਾਰੀ ਕਰਦੇ ਸਮੇਂ ਸਾਨੂੰ ਇਸ ਤਰ੍ਹਾਂ ਦੇ ਸਮਾਨ ਦੀ ਜ਼ਰੂਰਤ ਹੁੰਦੀ ਹੈ ਜੇਕਰ ਕੱਪੜੇ 'ਤੇ ਕਰਨਾ ਹੋਵੇ ਤਾਂ ਸਾਨੂੰ ਕੱਪੜਾ ਅਤੇ ਫਰੇਮ ਚਾਹੀਦਾ ਹੈ ਜੇ ਪੇਂਟਿੰਗ ਵੈਸੇ ਬਣਾਉਣੀ ਹੋਵੇ ਚਾਰਟ ਕਲਰ ਬਰੱਸ਼ ਦੂਜਾ ਟਰੇਅ ਬੋਰਡ ਜਿਸ 'ਤੇ ਰੱਖ ਕੇ ਕਰਨਾ ਹੈ ਉਹ ਸਾਰਾ ਸਮਾਨ ਚਾਹੀਦਾ ਹੈ ਇਹ ਸਮਾਨ ਅੱਜ ਕੱਲ੍ਹ ਵੈਸੇ ਬਹੁਤ ਮਹਿੰਗਾ ਹੈ ਪਰ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਦੁਕਾਨ ਹੈ ਉੱਥੋਂ ਸਾਨੂੰ ਸਾਰਾ ਸਮਾਨ ਮਿਲ ਜਾਂਦਾ ਹੈ ਜੇ ਕੱਪੜੇ 'ਤੇ ਕਰਨਾ ਹੋਵੇ ਤਾਂ ਉਸ ਵਿੱਚ ਮੀਡੀਅਮ ਦੀ ਵੀ ਲੋੜ ਪੈਂਦੀ ਹੈ ਟਰੇਸ ਕਰਨ ਵਾਸਤੇ ਟਰੇਸ ਪੇਪਰ ਦੀ ਪੈਨਸਲ ਦੀ ਇਹ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ਉਹਨੂੰ ਟਰੇਸ ਕਰਨ ਵਾਸਤੇ ਵੀ ਕੁਛ ਸਮਾਨ ਚਾਹੀਦਾ ਹੁੰਦਾ ਹੈ ਉਹ ਸਾਨੂੰ ਸਾਰਾ ਉਸੇ ਦੁਕਾਨ ਤੋਂ ਹੀ ਮਿਲ ਜਾਂਦਾ ਹੈ